ਸਾਡੇ ਭਾਰਤ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਮ ਦਾ ਇੱਕ ਬਹੁਤ ਹੀ ਮਸ਼ਹੂਰ ਰਾਜੇ ਸੀ ਇਹਨਾਂ ਦੇ ਚਾਰ ਪੁੱਤਰ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸ਼ਹੀਦੀ ਉਹਨਾਂ ਨੂੰ ਪਤਾ ਹੁੰਦੇ ਹੋਏ ਵੀ ਦਿੱਤੀ ਸੀ ਅਤੇ ਇਹਨਾਂ ਦੇ ਚਾਰ ਪੁੱਤਰ ਸਨ ਜਿਨ੍ਹਾਂ ਵਿੱਚੋਂ ਦੋ ਪੁੱਤਰਾਂ ਦੀ ਮੌਤ ਜੰਗ ਵਿੱਚ ਹੋਈ ਸੀ ਅਤੇ ਦੋ ਨੇ ਆਪਣੀ ਸ਼ਹੀਦੀ ਹੱਸਦੇ ਹੋਏ ਜ਼ਾਲਮਾਂ ਨੂੰ ਦੇ ਤੀ ਸੀ ਇਸ ਤੋਂ ਬਾਅਦ ਇੱਕ ਬੰਦਾ ਸਿੰਘ ਬਹਾਦਰ ਆਏ ਹਨ ਜਿਨ੍ਹਾਂ ਨੇ ਪੂਰੇ ਪੰਜਾਬ ਵਿੱਚ ਮੁਗਲਾਂ ਦੇ ਖਿਲਾਫ ਇੱਟ ਨਾਲ ਇੱਟ ਖੜਕਾ ਤੀ ਸੀ ਅਤੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਬਟ ਉਹਨਾਂ ਦੀ ਵੀ ਅੰਤ ਵਿੱਚ ਮ੍ਰਿਤੂ ਹੋ ਗਈ ਸੀ ਉਹਨਾਂ ਨੂੰ ਬਹੁਤ ਹੀ ਚਾਲ ਚਾਲਬਾਜ਼ੀ ਨਾਲ ਮਾਰਿਆ ਗਿਆ ਸੀ ਅਤੇ ਇਸ ਤੋਂ ਇਲਾਵਾ ਭਾਰਤ ਵਿੱਚ ਅਕਬਰ ਨੇ ਵੀ ਰਾਜ ਕੀਤਾ ਸੀ ਬਹੁਤ ਸਾਲ ਅਕਬਰ ਇੱਕ ਨਰਮ ਦਿਲ ਰਾਜਾ ਸੀ ਬਟ ਲੋਕਾਂ ਨੇ ਉਸ ਨੂੰ ਬਾਰੇ ਝੂਠੀਆਂ ਗੱਲਾਂ ਫੈਲਾਅ ਫੈਲਾਅ ਕੇ ਉਸ ਨੂੰ ਬਹੁਤ ਬਦਨਾਮ ਕਰ ਦਿੱਤਾ ਸੀ ਉਪਮਾਇਓ ਨਾਮ ਦਾ ਵੀ ਇੱਕ ਬਹੁਤ ਮਸ਼ਹੂਰ ਰਾਜਾ ਸੀ ਜਿਸ ਨੇ ਭਾਰਤ ਵਿੱਚ ਬਹੁਤ ਸਾਲ ਰਾਜ ਕੀਤਾ ਸੀ ਭਾਰਤ ਵਿੱਚ ਸਿਰਫ ਭਾਰਤੀਆਂ ਨੇ ਹੀ ਨਹੀਂ ਸਗੋਂ ਮੁਗਲਾਂ ਨੇ ਸਿੱਖਾਂ ਨੇ ਅੰਗਰੇਜ਼ਾਂ ਨੇ ਵੀ ਬਹੁਤ ਸਾਲ ਰਾਜ ਕੀਤਾ ਸੀ ਬਟ ਭਾਰਤੀ ਹਿੰਦੁਸਤਾਨੀ ਪਾਕਿਸਤਾਨੀ ਅਤੇ ਸਿੱਖਾਂ ਨੇ ਇਕੱਠੇ ਆ ਕੇ ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਵਿੱਚ ਬਹੁਤ ਜ਼ਿਆਦਾ ਮਦਦ ਕੀਤੀ ਹੈ